ਸਾਡੇ ਪੰਜਾਬ ਨੂੰ ਪ ਪੰਜ ਨਦੀਆਂ ਦੀ ਧਰਤੀ ਕਿਹਾ ਜਾਂਦਾ ਹੈ ਜਿਸ ਦਾ ਨਾਮ ਹੀ ਪੰਜ ਨਦੀਆਂ ਦੇ ਨਾਮ 'ਤੇ ਪੰਜ ਦਾ ਆਬ ਬਣਿਆ ਹੋਇਆ ਹੈ ਰੱਖਿਆ ਹੋਇਆ ਹੈ ਸਾਡੇ ਦੇਸ਼ ਵਿੱਚ ਪੰਜ ਨਦੀਆਂ ਚਲਦੀਆਂ ਸਨ ਸਤਲੁਜ ਬਿਆਸ ਰਾਵੀ ਚਨਾਬ ਜੇਹਲਮ ਬ ਜਦੋਂ ਪਾਕਿਸਤਾਨ ਅਤੇ ਪੰਜਾਬ ਦੀ ਵੰਡ ਹੋਈ ਉਸ ਤੋਂ ਬਾਅਦ ਇਹ ਨਦੀਆਂ ਦੀ ਵੰਡ ਹੋ ਗਈ ਜੋ ਕਿ ਤਿੰਨ ਨਦੀਆਂ ਪੰਜਾਬ ਵਿੱਚ ਅਤੇ ਦੋ ਨਦੀਆਂ ਪਾਕਿਸਤਾਨ ਵਿੱਚ ਚਲੀਆਂ ਗਈਆਂ ਸਾਡੇ ਪੰਜਾਬ ਵਿੱਚ ਸਤਲੁਜ ਬਿਆਸ ਰਾਵੀ ਨਦੀਆਂ ਹਨ ਚਨਾਬ ਅਤੇ ਜੇਹਲਮ ਪਾਕਿਸਤਾਨ ਵਿੱਚ ਹਨ ਸਾਡੇ ਦੇਸ਼ ਨੂੰ ਬਹੁਤ ਹੀ ਉਪਜਾਊ ਧਰਤੀ ਹੈ ਸ ਪੰਜਾਬ ਦੀ ਗੁਰਦਾਸਪੁਰ ਹੁਸ਼ਿਆਰਪੁਰ ਸੈਡ ਪਹਾੜੀ ਇਲਾਕਾ ਕਿਹਾ ਜਾਂਦਾ ਹੈ ਉਸ ਸਾਈਡ 'ਤੇ ਪਹਾੜ ਹਨ ਅਤੇ ਅਨੰਦਪੁਰ ਸਾਹਿਬ ਵੱਲ ਦੀ ਸਾਈਡ 'ਤੇ ਵੀ ਪਹਾੜਾਂ ਦਾ ਏਰੀਆ ਕਿਹਾ ਜਾਂਦਾ ਹੈ ਸਾਡੇ ਪੰਜਾਬ ਮਾਲਵੇ ਦੀ ਧਰਤੀ ਬਹੁਤ ਹੀ ਉਪਜਾਊ ਹੈ ਜਿਸ ਉੱਪਰ ਬਹੁਤ ਵਧੀਆ ਫਸਲ ਉਗਾਈ ਜਾਂਦੀ ਹੈ ਬਿਆਸ ਨਦੀ ਦੇ ਕੰਢੇ ਉੱਪਰ ਬਿਆਸ ਸ਼ਹਿਰ ਵਗਿਆ ਵਸਿਆ ਹੋਇਆ ਹੈ ਲ ਲੁਧਿਆਣਾ ਸ਼ਹਿਰ ਵੀ ਸਤਲੁਜ ਨਦੀ ਦੇ ਬ ਚੱਲਦੀ ਹੈ ਜੋ ਕਿ ਲੁਧਿਆਣੇ ਸ਼ਹਿਰ ਦੇ ਕੋਲ ਦੀ ਲੰਘਦੀ ਹੈ ਸਾਡੇ ਦੇਸ਼ ਵਿੱਚ ਕਈ ਡੈਮ ਚੱਲਦੇ ਹਨ ਜਿਨ੍ਹਾਂ ਵਿੱਚੋਂ ਨੰਗਲ ਡੈਮ ਰਣਜੀਤ ਸਾਗਰ ਡੈਮ ਡੋਲਬਹਾ ਡੈਮ ਚਹੋ ਚਹੋਲ ਡੈਮ ਥਾਣਾ ਡੈਮ ਸ਼ਿਸ਼ਮਨ ਡੈਮ ਹਨ ਗੁਰਦਾਸਪੁਰ ਹੁਸ਼ਿਆਰਪੁਰ ਸ ਸਾਈਡ ਦੀ ਧਰਤੀ ਬਹੁਤ ਜ਼ਿਆਦਾ ਉਪਜਾਊ ਧਰਤੀ ਹੈ ਜਿਸ ਉੱਪਰ ਬਹੁਤ ਵਧੀਆ ਫਸਲਾਂ ਉਗਾਈਆਂ ਜਾਂਦੀਆਂ ਹਨ ਸਾਡੇ ਮਾਲਵੇ ਦੀ ਧਰਤੀ 'ਤੇ ਵੀ ਹਰ ਤਰ੍ਹਾਂ ਦੀ ਫਸਲ ਉਗਾਈ ਜਾਂਦੀ ਹੈ ਜੋ ਕਿ ਬਹੁਤ ਉਪਜਾਊ ਹੈ ਸਾਡੇ ਦੇਸ਼ ਦਾ ਮੌਸਮ ਵੀ ਬਹੁਤ ਵਧੀਆ ਰਹਿੰਦਾ ਹੈ ਜਿਵੇਂ ਸ਼ਿਮਲੇ ਸਾਈਡ ਚੰਡੀਗੜ੍ਹ ਸਾਈਡ ਅਤੇ ਕਾਫ਼ੀ ਜ਼ਿਆਦਾ ਠੰਡ ਪੈਂਦੀ ਹੈ ਬਾਰਿਸ਼ ਹੁੰਦੀ ਹੈ ਉਹ ਮੌਸਮ ਵੀ ਬਹੁਤ ਵਧੀਆ ਹੁੰਦਾ ਹੈ